ਹੈਲੋ ਤੁਸੀਂ ਸੇਤੀਆ ਹੋਟਲ ਤੋਂ ਗੱਲ ਕਰਦੇ ਹੋ ਮੈਂ ਤੁਹਾਡੇ ਤੋਂ ਕੁਛ ਖਾਣ ਪੀਣ ਦੀਆਂ ਚੀਜ਼ਾਂ ਓਰਡਰ ਕੀਤੀਆਂ ਸੀ ਜਿਵੇਂ ਕਿ ਪੀਜ਼ਾ ਬਰਗਰ ਮੋਮਸ ਸਾਡੇ ਘਰ ਰਿਸ਼ਤੇਦਾਰਾਂ ਨੇ ਆਉਣਾ ਤਾਂ ਮੈਂ ਉਹਦੇ ਵਿੱਚ ਤੁਹਾਡੇ ਤੋਂ ਕੁਛ ਟੋਪਿੰਗਸ ਐਡ ਕਰਵਾਉਣੀਆਂ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਕੀ ਕੀ ਉਪਲਬਧ ਹਨ ਜਿਵੇਂ ਕਿ ਓਰੀਗੈਨੋਜ਼ ਵਗੈਰਾ ਵਗੈਰਾ ਅਤੇ ਤੁਸੀਂ ਦੱਸ ਸਕਦੇ ਹੋ ਤੁਹਾਡੇ ਕੋਲ ਕਿਹੋ ਜਿਹੀਆਂ ਚਟਣੀਆਂ ਜਾਂ ਸੋਸਾਂ ਉਪਲਬਧ ਹਨ